ਮੋਹਾਲੀ ਜ਼ਿਲ੍ਹੇ ਦਾ ਵਾਤਾਵਰਨ ਪਾਣੀਆਂ ਦੀ ਵਜ੍ਹਾ ਕਰਕੇ ਇਉਂ ਇਹ ਪਾਣੀ ਦੇ ਹੜ੍ਹਾਂ ਦੇ ਵਿੱਚ ਪਹਾੜ ਨੇੜੇ ਨੇੜੇ ਹੋਣ ਕਰਕੇ ਪਾਣੀ ਦਾ ਵਹਿਣ ਬਹੁਤ ਜ਼ਿਆਦਾ ਹੈ